ਬੱਚਿਆਂ ਨੂੰ ਸਕੂਲਾਂ ਵਿੱਚ ਬੈਂਕ ਦੀਆਂ ਨੀਤੀਆਂ ਕਰਜ਼ੇ ਰਿਟਰਨ ਟੈਕਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੇਸ਼ ਦਾ ਆਉਣ ਵਾਲਾ ਭਵਿੱਖ ਹੈ ਇਹਨਾਂ ਦੇ ਹੀ ਸਿਰ ਦੇ ਉੱਤੇ ਸਾਰਾ ਭਾਰ ਆਉਣਾ ਹੈ ਕਿਉਂਕਿ ਇਹ ਇਸ ਕਰਕੇ ਵੀ ਜ਼ਰੂਰੀ ਹੈ ਕਿ ਅੱਜ ਕੱਲ੍ਹ ਕਾਫੀ ਲੋਨ ਮਿਲਦੇ ਹਨ ਉਹਨਾਂ ਦੀ ਰਿਟਰਨ ਬਾਰੇ ਜਾਂ ਕਰਜ਼ੇ ਮਿਲਦੇ ਹਨ ਐਜੂ ਪੜ੍ਹਾਈ ਵਿਆ ਬੇਸ ਦੇ ਉੱਤੇ ਉਹਨਾਂ ਬਾਰੇ ਵੀ ਇਹਨਾਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਫਿਰ ਉਹਨਾਂ ਨੂੰ ਮੋੜਨਾ ਕਿਸ ਤਰ੍ਹਾਂ ਹੈ ਵੀ ਕੇ ਕਿਸ ਨੀਤੀ ਰਾਹੀਂ ਮੋੜਨਾ ਜ਼ਰੂਰੀ ਹੈ ਮੋੜਨਾ ਜ਼ਰੂਰੀ ਹੈ ਕਿਸ ਕਰਕੇ ਕਿੰਨੇ ਸਮੇਂ ਵਿੱਚ ਕਿੰਨੀ ਇਹਨਾਂ ਨੂੰ ਜ਼ਿਆਦਾ ਕਰਜ਼ਾ ਕਰਜ਼ੇ ਦੇ ਉੱਤੇ ਵਿਆਜ ਲੱਗੇਗਾ ਉਹਦੀ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ ਜਿਵੇਂ ਕਿ ਮੈਥ ਵਿੱਚ ਕੰਪਾਉਂਡ ਇੰਟਰਸਟ ਪੜ੍ਹਾਇਆ ਜਾਂਦਾ ਹੈ ਉਸ ਤਰ੍ਹਾਂ ਹੀ ਬੈਂਕ ਵਿੱਚ ਵਿਆਜ ਲੱਗਦਾ ਹੈ ਪਰ ਪੂਰੀ ਜਾਣਕਾਰੀ ਨਾ ਹੋਣ ਕਰਕੇ ਫਿਰ ਉਹ ਰਿਟਾ ਕਰਜ਼ੇ ਮੋੜਨ ਵਿੱਚ ਅਸਮਰੱਥ ਰਹਿ ਜਾਂਦੇ ਹਨ ਕਿਉਂਕਿ ਬਹੁਤ ਸਾਰੀ ਅਜੇ ਇਸ ਦੀ ਸਿੱਖਣ ਦੀ ਲੋੜ ਹੈ ਆਮ ਬੰਦੇ ਨੂੰ ਵੀ ਇਸ ਬਾਰੇ ਪਤਾ ਨਹੀਂ ਹੁੰਦਾ ਵੀ ਬੈਂਕਾਂ ਕਿਸ ਤਰੀਕੇ ਨਾਲ ਕਰਜ਼ੇ ਦਿੰਦੀਆਂ ਹਨ ਅਤੇ ਉਹਨਾਂ ਦੇ ਉੱਤੇ ਕਿਸ ਤਰੀਕੇ ਨਾਲ ਵਿਆਜ ਲਗਾਉਂਦੀਆਂ ਹਨ ਬੈਂਕਾਂ ਵਿੱਚ ਬਹੁਤ ਹੀ ਤਰੀਕੇ ਦੇ ਨਾਲ ਨੀਤੀਆਂ ਦੇ ਨਾਲ ਲੋਨ ਦਿੱਤੇ ਜਾਂਦੇ ਹਨ ਘਰ ਦੇ ਉੱਤੇ ਘਰ ਦੇ ਜਾਇਦਾਦ ਉੱਤੇ ਖੇਤਾਂ ਦੇ ਉੱਤੇ ਐਗਰੀਕਲਚਰ ਉੱਪਰ ਐਗਰੀਕਲਚਰ ਦੇ ਸੰਦਾਂ ਦੇ ਉੱਪਰ ਟੈਕਸਾਂ ਦੇ ਇਹ ਉਹਦੇ ਉੱਤੇ ਉੱਪਰ ਵੱਖਰੇ ਟੈਕਸ ਲਾਏ ਜਾਂਦੇ ਹਨ ਕਈ ਵਾਰੀ ਤਾਂ ਅਣਜਾਣ ਆਦਮੀ ਇਹਨਾਂ ਵਿੱਚ ਡਬਲ ਕਰਜ਼ਿਆਂ ਦੀ ਨੀਤੀ ਵਿੱਚ ਫਸ ਜਾਂਦੇ ਹਨ ਫਿਰ ਵੀ ਅਸੀਂ ਇਹ ਸੁਜੈਸਟ ਕਰਦੇ ਹਾਂ ਕਿ ਕਰਜ਼ਿਆਂ ਨੂੰ ਕਰਜ਼ੇ ਨੀਤੀ ਨੂੰ ਵੱਧ ਤੋਂ ਵੱਧ ਛੋਟੇ ਹੁੰਦਿਆਂ ਹੀ ਬੱਚਿਆਂ ਨੂੰ ਸਿਖਾਇਆ ਜਾਵੇ ਬੈਂਕ ਦਾ ਇੱਕ ਵੱਖਰਾ ਹੀ ਸਿਲੇਬਸ ਐਡ ਕੀਤਾ ਜਾਵੇ ਜਿਸ ਵਿੱਚ ਹਰ ਇੱਕ ਨੀਤੀ ਬਾਰੇ ਜਾਣਕਾਰੀ ਹੋਵੇ ਬੈਂਕ ਵਿੱਚ ਪੈਸੇ ਕਿੱਦਾਂ ਜਮ੍ਹਾਂ ਕਰਵਾਉਣੇ ਨੇ ਕਢਾਉਣੇ ਕਿਸ ਤਰ੍ਹਾਂ ਹਨ ਜੇ ਕਰਜ਼ਾ ਲੈਣਾ ਹੈ ਤਾਂ ਉਸ ਦੇ ਉੱਪਰ ਲੋਨ ਕਿਸ ਤਰ੍ਹਾਂ ਕਿਸ ਤਰ੍ਹਾਂ ਮੈਂ ਉਹਦੇ ਉੱਪਰ ਵਿਆਜ ਕਿੰਨਾ ਲੱਗਣਾ ਹੈ ਉਹਦੀ ਕਿਸ਼ਤ ਕਿੰਨੀ ਬਣਨੀ ਹੈ ਉਸ ਤੋਂ ਬਾਅਦ ਉਹਦੇ ਉੱਤੇ ਟੈਕਸ ਪੈਂਦਾ ਹੈ ਜਾਂ ਨਹੀਂ ਪੈਂਦਾ ਹੈ ਇਹਦੇ ਬਾਰੇ ਵੀ ਜਾਣਕਾਰੀ ਦੇਣੀ ਜ਼ਰੂਰੀ ਹੈ